ਹੈਲੋ ਹਾਂਜੀ ਸਰ ਮੈਂ ਬੰਗਲੌਰ ਰਹਿੰਦਾ ਹਾਂਜੀ ਸਰ ਮੈਨੂੰ ਮਤਲਬ ਪੁੱਛਣਾ ਸੀਗਾ ਵੀ ਮੈਂ ਚੇਨੱਈ ਜਾਣਾ ਚਾਹੁੰਦਾ ਹਾਂਜੀ ਅਤੇ ਉਹਦੇ ਬਾਰੇ ਤੁਸੀਂ ਦੱਸੋ ਮਤਲਬ ਟ੍ਰੇਨ ਦਾ ਟਾਈਮ ਜਾਂ ਟਿਕਟ ਦਾ ਕਿਰਾਇਆ ਕਿੱਦਾਂ ਵੀ ਅਸੀਂ ਪਸੈਨਜਰ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਏ ਸਰ ਸਰ ਇਹਦਾ ਮਤਲਬ ਕਿੰਨਾ ਟਾਈਮ ਲੱਗਦਾ ਪਹੁੰਚਦੇ ਪਹੁੰਚਦੇ ਕਿੰਨਾ ਟਾਈਮ ਲਾਉਂਦੀ ਹੈ ਬੰਗਲੋਰ ਤੋਂ ਚੇਨੱਈ ਅੱਛਾ ਠੀਕ ਠੀਕ ਹੈ ਸਰ ਅੱਛਾ ਇਹ ਚਾਰ ਹੀ ਟਾਈਮ ਨੇ ਮਤਲਬ ਫਿਕਸ ਇਸ ਤੋਂ ਇਲਾਵਾ ਕੋਈ ਟਾਈਮ ਨਹੀਂ ਹੈ ਸਰ ਅੱਛਾ ਅੱਛਾ ਹਾਂਜੀ ਸਰ ਸਰ ਇਹਦਾ ਕਿਰਾਇਆ ਕਿੰਨਾ ਟਿਕਟ ਦਾ ਠੀਕ ਹੈ ਸਰ ਬੁਕਿੰਗ ਸਨੈਰੀਓ ਕੀ ਹੋਵੇਗਾ ਤੁਸੀਂ ਦੱਸ ਸਕਦੇ ਹੋ ਡਿਟੇਲਸ ਅੱਛਾ ਅੱਛਾ ਅੱਛਾ ਸਰ ਅੱ ਠੀਕ ਹੈ ਸਰ ਸਰ ਜਿੱਦਾਂ ਇਹ ਆਫਲਾਈਨ ਮੰਨ ਲਿਓ ਕਿੰਨਾ ਕੁ ਟਾਈਮ ਪਹਿਲਾਂ ਭੀੜ ਜਾਂ ਰਸ਼ ਤਾਂ ਨਹੀਂ ਹੁੰਦਾ ਟਿਕਟ ਲੈਣ ਸਮੇਂ ਅੱਛਾ ਠੀਕ ਹੈ ਸਰ ਠੀਕ ਸਰ ਥਰੀ ਫਿਫਟੀਨ ਤੋਂ ਬਾਅਦ ਵਾਲਾ ਟਾਈਮ ਕਿਹੜਾ ਦੱਸਿਆ ਸੀ ਤੁਸੀਂ ਅੱਛਾ ਸਰ ਸਰ ਉਹਦੇ 'ਤੇ ਆਨਲਾਈਨ ਬੁਕਿੰਗ ਕਰਵਾਉਣੀ ਸੀਗੀ ਦੋ ਕੁ ਮਿੰਟ ਦੱਸਿਓ ਸਰ ਕੋਈ ਹੈਗਾ ਠੀਕ ਹੈ ਸਰ ਠੀਕ ਹੈ ਸਰ ਹਾਂਜੀ ਹਾਂਜੀ ਠੀਕ ਆ ਕੋਈ ਨਾ ਸਰ ਮੈਂ ਫਿਰ ਟਰਾਈ ਕਰੂੰਗਾ ਆਨਲਾਈਨ ਜੇ ਨਾ ਹੋਇਆ ਤਾਂ ਮੈਨੂੰ ਆਫਲਾਈਨ ਥੋੜ੍ਹਾ ਜਲਦੀ ਆਉਣਾ ਪੈ ਜੇਗਾ ਠੀਕ ਹੈ ਸਰ ਹਾਂਜੀ ਹਾਂਜੀ ਸਰ ਸਰ ਇਹ ਤਾਂ ਫਿਰ ਫਾਈਵ ਆਵਰਸ ਪੂਰੇ ਲੱਗਣਗੇ ਲਗਭਗ ਹੈ ਨਾ ਟ੍ਰੇਨ ਮਤਲਬ ਜਲਦੀ ਤਾਂ ਨਹੀਂ ਪਹੁੰਚਿਆ ਜਾਣਾ ਇਹਦੇ 'ਤੇ ਅੱਛਾ ਉਹਦੇ ਲਈ ਫਿਰ ਐਕਸਪ੍ਰੈਸ ਜਾਂ ਕੋਈ ਹੋਰ ਹੋਵੇ ਕੋਈ ਐਕਸਪਰੈਸ ਟ੍ਰੇਨ ਹੋਵੇ ਮਤਲਬ ਜਲਦੀ ਪਹੁੰਚਾਉਂਦੀ ਉਹ ਦਾ ਟਾਈਮਿੰਗ ਕੀ ਹੈ ਅੱਛਾ ਅੱਛਾ ਅੱਛਾ ਉਹ ਲਾ ਦੂਗੀ ਤਿੰਨ ਸਾਢੇ ਤਿੰਨ ਘੰਟੇ 'ਚ ਠੀਕ ਹੈ ਸਰ ਫਿਰ ਮੈਂ ਉਹਦਾ ਹੀ ਟਰਾਈ ਕਰਨਾ ਕਿਉਂਕਿ ਸਰ ਮੈਂ ਜਲਦੀ ਪਹੁੰਚਣਾ ਸੀ ਠੀਕ ਹੈ ਸਰ